ਮੈਂ ਦੱਸਣ ਜਾ ਰਹੀ ਹਾਂ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਆਪਣੇ ਹੱਥਾਂ ਨਾਲ ਬਣਾ ਕੇ ਕੋਈ ਵੀ ਗ੍ਰੀਟਿੰਗ ਕਾਰਡ ਜਾਂ ਸ਼ੁਭ ਇੱਛਾਵਾਂ ਲਿਖ ਕੇ ਦਿੰਦੇ ਸੀ ਪਰ ਅੱਜ ਕੱਲ੍ਹ ਆਰਟੀਫਿਸ਼ੀਅਲ ਕਾਰਡ ਚੱਲ ਪਏ ਨੇ ਜਿਹਨਾਂ ਦਾ ਮੁੱਲ ਕਿ ਉਹਨਾਂ ਨਹੀਂ ਹੈ ਜਿੰਨਾ ਕਿ ਹੱਥਾਂ ਨਾਲ ਬਣਾਈ ਚੀਜ਼ ਦਾ ਹੈ ਉਦੋਂ ਅਸੀਂ ਲੋਹੜੀ ਦਿਵਾਲੀ ਹੋਲੀ ਜਾਂ ਜਨਮਦਿਨ 'ਤੇ ਆਪਣੇ ਹੱਥਾਂ ਨਾਲ ਬਣਾ ਕੇ ਤੋਹਫੇ ਦਿੰਦੇ ਸੀ ਮਤਲਬ ਇੱਕ ਇਹ ਪੇਂਟਿੰਗ ਬਣਾ ਕੇ ਦਿੰਦੇ ਸੀ ਉਹ ਹੱਥਾਂ ਨਾਲ ਫੁੱਲ ਛਾਪਦੇ ਤਸਵੀਰਾਂ ਕੱਟ ਕੇ ਲਾਉਂਦੇ ਸ਼ੇਅਰ ਲਿਖਦੇ ਉਹਦੇ ਵਿੱਚ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਅਤੇ ਜੋ ਇੱਦਾਂ ਦੇ ਮਤਲਬ ਆਪਾਂ ਗਿਫਟ ਜਾਂ ਤੋਹਫ਼ੇ ਦਿੰਦੇ ਹਾਂ ਤਾਂ ਉਹਨਾਂ ਦੂਜੇ 'ਤੇ ਪ੍ਰਭਾਵ ਵੀ ਬਹੁਤ ਜ਼ਿਆਦਾ ਪੈਂਦਾ ਅਸੀਂ ਆਪਣੀ ਮਿਹਨਤ ਨਾਲ ਬਣਾ ਕੇ ਚੀਜ਼ ਦਿੰਦੇ ਹਾਂ ਅਤੇ ਇਹਦੇ ਨਾਲ ਸਾਡਾ ਭਾਵਨਾਤਮਕ ਰਿਸ਼ਤਾ ਜੁੜ ਜਾਂਦਾ ਪਰ ਅੱਜ ਕੱਲ੍ਹ ਆਰਟੀਫਿਸ਼ਅਲ ਚੀਜ਼ਾਂ ਦੇਖਣ ਨੂੰ ਬਹੁਤ ਸੋਹਣੀਆਂ ਹਨ ਪਰ ਉਹਦਾ ਇੰਨਾ ਮੁੱਲ ਨਹੀਂ ਹੈ ਉਹਦੇ ਵਿੱਚ ਇੰਨੀਆਂ ਭਾਵਨਾਵਾਂ ਜਾਂ ਫੀਲਿੰਗਸ ਜਾਂ ਜੋ ਸਾਡਾ ਮੋਹ ਪਿਆਰ ਹੈ ਉਹ ਇੰਨਾ ਸ਼ਾਇਦ ਪ੍ਰਗਟ ਨਹੀਂ ਹੁੰਦਾ ਜੋ ਪਹਿਲਾਂ ਹੁੰਦਾ ਸੀ ਕਿਉਂਕਿ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਫਿਰ ਉਹਨਾਂ ਨੂੰ ਬਹੁਤ ਹੀ ਸਿਸਟਮੈਟਿਕ ਤਰੀਕੇ ਨਾਲ ਢੰਗ ਨਾਲ ਲਾਉਣਾ ਇਹ ਸਾਡੇ 'ਚ ਹੁੰਦਾ ਸੀ ਪਰ ਅੱਜ ਕੱਲ੍ਹ ਇੱਦਾਂ ਨਹੀਂ ਹੈ ਬਾਜ਼ਾਰ ਤੋਂ ਲੈ ਕੇ ਆਉਣੇ ਆ ਅਤੇ ਉਹ ਉਦਾਂ ਮਤਲਬ ਦੇ ਦਿੰਦੇ ਹਾਂ ਉਹ ਮਤਲਬ ਉਨਾ ਮਤਲਬ ਫੀਲ ਨਹੀਂ ਹੁੰਦਾ ਉਹਨਾਂ 'ਚ ਇਹ ਹੀ ਹੈ